ਹੈਲੋ ਹਾਂਜੀ ਸਰ ਹਾਂਜੀ ਹਾਂਜੀ ਸਰ ਮੈਂ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਤੋਂ ਬੋਲ ਰਿਹਾ ਅਤੇ ਇਸ ਸਾਲ ਮੇਰੀ ਐਡਮਿਸ਼ਨ ਹੋਈ ਸੀ ਇੱਥੇ ਅਤੇ ਮੈਂ ਵੈਸੇ ਜੰਮੂ ਦਾ ਰਹਿਣ ਵਾਲਾ ਅਤੇ ਜਦੋਂ ਹੁਣ ਇੱਥੇ ਐਡਮਿਸ਼ਨ ਹੋਈ ਆ ਮੇਰੀ ਤਾਂ ਮੈਂ ਇੱਥੇ ਆ ਕੇ ਦੇਖਿਆ ਤਾਂ ਇੱਥੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਅਤੇ ਮੈਂ ਉਹ ਹੀ ਪੁੱਛਣ ਲਈ ਮਤਲਬ ਇਹ ਹੀ ਪੁੱਛਣਾ ਚਾਹੁੰਦਾ ਵੀ ਮਤਲਬ ਜਿਹੜਾ ਕੀ ਕਾਰਨ ਆ ਵੀ ਜਿਹੜੀ ਗਰਮੀ ਇੱਥੇ ਇੰਨੀ ਜ਼ਿਆਦਾ ਪੈ ਰਹੀ ਆ ਇਸ ਸਾਲ ਠੀਕ ਹੈ ਜੀ

ਠੀਕ ਹੈ ਜੀ ਹਾਂਜੀ

ਠੀਕ ਹੈ ਜੀ ਹਾਂ ਉਹ ਮਤਲਬ ਇੱਥੇ ਆਪਣੇ ਜੀ ਯੂਨੀਵਰਸਿਟੀ ਦੇ ਉਹ ਨੇੜੇ ਹੀ ਹੈ ਰਿਫਾਇਨਰੀ ਠੀਕ ਹੈ ਮਤਲਬ ਉਹਦਾ ਪ੍ਰਭਾਵ ਪੈਂਦਾ ਹੈਗਾ ਯੂਨੀਵਰਸਿਟੀ ਦੀ ਬਠਿੰਡੇ 'ਤੇ ਠੀਕ ਹੈ ਜੀ

ਠੀਕ ਹੈ ਜੀ ਅਤੇ ਮਤਲਬ ਫਿਰ ਇਹਦੇ ਕੀ ਤਾਂ ਇਹਦੇ ਹੋ ਸਕਦੇ ਨੇ ਮਤਲਬ ਵੀ ਪ੍ਰਭਾਵ ਤਾਂ ਆਪਾਂ ਨੂੰ ਦਿੱਖ ਹੀ ਰਹੇ ਨੇ ਵੀ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਮਤਲਬ ਕੀ ਸੁਝਾਅ ਤਾਂ ਮਤਲਬ ਆਪਾਂ ਕੀ ਇਹਦੇ ਬਾਰੇ ਦੇਖ ਸਕਦੇ ਹਾਂ ਠੀਕ ਹੈ ਠੀਕ ਠੀਕ ਠੀਕ ਹੈ ਸਰ ਥੈਂਕ ਯੂ